ਪੰਜਾਬ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ ਅਤੇ ਉਹ ਹਰੇਕ ਤਿਉਹਾਰ ਨੂੰ ਆਪਣਾ ਵਿਸ਼ਵਾਸ ਰੱਖ ਕੇ ਮਨਾਉਂਦੇ ਹਨ ਪੰਜਾਬ ਵਿੱਚ ਬਹੁਤ ਸਾਰੇ ਧਰਮ ਹੋਣ ਦੇ ਨਾਤੇ ਲੋਕਾਂ ਦਾ ਆਪਣਾ ਆਪਣਾ ਵਿਸ਼ਵਾਸ ਹੈ ਉਹ ਆਪਣੇ ਜੀਵਨ ਵਿੱਚ ਪਰਮਾਤਮਾ ਨੂੰ ਬਹੁਤ ਜਿਆਦਾ ਵਿਸ਼ਵਾਸ ਰੱਖ ਕੇ ਮਨਾਉਂਦੇ ਹਨ ਅਤੇ ਆਪਣੇ ਤਰੀਕੇ ਦੇ ਨਾਲ ਹੀ ਉਹ ਹਰ ਤਿਉਹਾਰ ਨੂੰ ਮਨਾਉਂਦੇ ਹਨ ਪੰਜਾਬ ਵਿੱਚ ਬਹੁਤ ਸਾਰੇ ਧਰਮ ਹਨ ਜਿਵੇਂ ਕਿ ਹਿੰਦੂ ਮੁਸਲਿਮ ਸਿੱਖ ਈਸਾਈ ਜੈਨ ਇਹ ਸਭ ਧਰਮ ਸਾਂਝੇ ਹਨ ਅਜੋਕੇ ਸਮੇਂ ਵਿੱਚ ਲੋਕਾਂ ਨੇ ਇਹਨਾਂ ਨੂੰ ਵੱਖ ਵੱਖ ਨਾਮ ਦੇ ਦਿੱਤੇ ਹਨ ਪਰ ਪਰਮਾਤਮਾ ਇੱਕ ਹੀ ਹੈ ਹਰੇਕ ਮਨੁੱਖ ਦਾ ਵਿਸ਼ਵਾਸ ਪਰਮਾਤਮਾ ਨਾਲ ਜੁੜਿਆ ਹੋਇਆ ਹੈ ਪਰ ਜੇ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ਦੇ ਲੋਕ ਪਰਮਾਤਮਾ ਨੂੰ ਬਹੁਤ ਹੀ ਮੰਨਦੇ ਹਨ ਅਤੇ ਉਹ ਆਪਣੇ ਲੋਕ ਜੀਵਨ ਦੇ ਵਿੱਚ ਅਜਿਹੀਆਂ ਘਟਨਾਵਾਂ ਨੂੰ ਪਰਮਾਤਮਾ ਨਾਲ ਸੰਬੰਧਿਤ ਰੱਖਦੇ ਹਨ ਅਤੇ ਵਿਸ਼ਵਾਸ ਅਤੇ ਸ਼ਰਧਾ ਰੱਖ ਕੇ ਹੀ ਉਹ ਪਰਮਾਤਮਾ ਦੇ ਨਾਮ 'ਤੇ ਹਰ ਕੰਮ ਨੂੰ ਕਰਨਾ ਚਾਹੁੰਦੇ ਹਨ ਕਿਉਂਕਿ ਉਹ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਹਨ ਜਦੋਂ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਰਮਾਤਮਾ 'ਤੇ ਵਿਸ਼ਵਾਸ ਰੱਖਦੇ ਹਨ ਅਤੇ ਹਰ ਸਮੱਸਿਆ ਦਾ ਹੱਲ ਹੀ ਪਰਮਾਤਮਾ ਤੋਂ ਹੀ ਲੱਭਦੇ ਹਨ ਜਿਵੇਂ ਕਿ ਲੋਕ ਵੱਖ ਵੱਖ ਵੱਖ ਥਾਵਾਂ 'ਤੇ ਜਾ ਕੇ ਧਾਰਮਿਕ ਸਥਾਨਾਂ 'ਤੇ ਲੰਗਰ ਲਗਾਉਂਦੇ ਹਨ ਕਿਉਂਕਿ ਉਹਨਾਂ ਦੀ ਸ਼ਰਧਾ ਹੈ ਕਿ ਜੇ ਅਸੀਂ ਕੋਈ ਦਾਨ ਪੁੰਨ ਕਰਨਾ ਹੈ ਤਾਂ ਅਸੀਂ ਲੰਗਰ ਲਗਾਈਏ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਭੋਜਨ ਛਕਾ ਕੇ ਆਪਣਾ ਚ ਪੈਸਾ ਚੰਗੇ ਕੰਮ ਵਿੱਚ ਲਗਾ ਸਕੀਏ ਜਦੋਂ ਕਿਸੇ ਵੀ ਸਮੱਸਿਆ ਆਉਂਦੀ ਹੈ ਜਾਂ ਚਾਹੇ ਉਹ ਖੁਸ਼ੀ ਹੋਵੇ ਚਾਹੇ ਉਹ ਗਮੀ ਹੋਵੇ ਪੰਜਾਬ ਦੇ ਲੋਕ ਵੱਧ ਤੋਂ ਵੱਧ ਧਾਰਮਿਕ ਸਥਾਨਾਂ 'ਤੇ ਜਾਂਦੇ ਹਨ ਅਤੇ ਆਪਣੀ ਸ਼ਰਧਾ ਪਰਮਾਤਮਾ ਅੱਗੇ ਵਿਅਕਤ ਕਰਦੇ ਹਨ ਕੀਰਤਨ ਸੁਣ ਕੇ ਸ਼ਬਦ ਗੁਰਬਾਣੀ ਮੂੰਹੋਂ ਬੋਲ ਕੇ ਉਹ ਆਪਣੇ ਦੁੱਖ ਪ੍ਰਗਟ ਕਰਦੇ ਹਨ ਤਾਂ ਕਿ ਉਹ ਪਰਮਾਤਮਾ ਦੇ ਨਾਲ ਹੀ ਜੁੜੇ ਰਹਿ ਸਕਣ ਅਤੇ ਵੱਧ ਤੋਂ ਵੱਧ ਲੰਗਰ ਲਗਾ ਕੇ ਜਾਂ ਪਰਮਾਤਮਾ ਦੀ ਵਿਚਾਰਾਂ ਵਿਚਾਰ ਸਾਂਝੇ ਕਰਦੇ ਹਨ ਅਤੇ ਲੋਕਾਂ ਨੂੰ ਵੀ ਪਰਮਾਤਮਾ ਨਾਲ ਜੁੜਨ ਦੀ ਪ੍ਰੇਰਨਾ ਦਿੰਦੇ ਹਨ